ਸਰਕਾਰ ਰਾਜ ਵਿੱਚ ਛੋਟੇ ਕਾਰੋਬਾਰਾਂ ਦੀ ਬਹੁਤ ਮਦਦ ਕਰਦੀ ਹੈ ਛੋਟੇ ਕਾਰੋਬਾਰ ਜਿਹੜੇ ਕੀ ਘਰਾਂ ਦੇ ਵਿੱਚ ਇੰਡਸਟਰੀਆਂ ਲਗਾ ਕੇ ਕੀਤੇ ਜਾਂਦੇ ਹਨ ਜਿਵੇਂ ਟੋਕਰੀਆਂ ਬਣਾਉਣਾ ਝੰਡੀਆਂ ਬਣਾਉਣਾ ਲਿਫਾਫੇ ਬਣਾਉਣਾ ਇਸ ਤਰ੍ਹਾਂ ਦੇ ਕਾਰੋਬਾਰ ਇਹਨਾਂ ਵਿੱਚ ਸਰਕਾਰ ਮਸ਼ੀਨਾਂ ਦੇ ਉੱਤੇ ਸਬਸਿਡੀ ਪ੍ਰੋਵਾਈਡ ਕਰਦੀ ਹੈ ਅਤੇ ਘਰਾਂ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਜਗ੍ਹਾ ਵੀ ਮੁਫ਼ਤ ਦਿੱਤੀ ਜਾਂਦੀ ਹੈ ਇਸ ਦੇ ਨਾਲ ਕਾਰੋਬਾਰਾਂ ਵਿੱਚ ਵਾਧਾ ਹੁੰਦਾ ਹੈ ਬੇਰੁਜ਼ਗਾਰੀ ਘਟਦੀ ਹੈ ਜਿਸ ਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੁੰਦਾ ਹੈ ਅਤੇ ਸਾਡੀ ਪੜ੍ਹੀ ਲਿਖੀ ਜਨਤਾ ਨੂੰ ਕੰਮ ਵੀ ਮਿਲਦਾ ਹੈ